ਮੈਂ ਐਮਾਜੋਨ ਤੋਂ ਈਅਰ ਫ਼ੋਨ ਆਡਰ ਕੀਤੇ ਸਨ ਬਹੁਤ ਵਧੀਆ ਏਅਰ ਫ਼ੋਨ ਨੇ ਬਹੁਤ ਕੁਆਲਟੀ ਹੈ ਇਨ੍ਹਾਂ ਦੀ ਸਾਊਂਡ ਕੁਆਲਟੀ ਵੀ ਅੱਛੀ ਹੈ ਔਰ ਬਹੁਤ ਵਧੀਆ ਮਤਲਬ ਕਲੀਅਰਲੀ ਸਾਊਂਡ ਕੁਆਲਟੀ ਆ ਰਹੀ ਇਨ੍ਹਾਂ ਦੀ ਐਂਡ ਬਹੁਤ ਵਧੀਆ ਹੈੱਡ ਫ਼ੋਨ ਨੇ ਔਰ ਮੈਂ ਤਾਂ ਹੀ ਇਹ ਕਹਿਨਾ ਕਿ ਬਹੁਤ ਵਧੀਆ ਮਤਲਬ ਕੇ ਇੱਕ ਐਮਾਜੋਨ ਵਧੀਆ ਇੱਕ ਐਪ ਜਿਸ ਤੋਂ ਮਤਲਬ ਕੇ ਅਸੀਂ ਬਹੁਤ ਵਧੀਆ ਚੀਜ਼ਾਂ ਇਲੈਕਟ੍ਰੋਨਿਕ ਜਾਂ ਕੋਈ ਵੀ ਚੀਜ਼ਾਂ ਮਤਲਬ ਕੇ ਅਸੀਂ ਆਰ ਆਡਰ ਕਰ ਸਕਦੇ ਹਾਂ ਔਰ ਸਮੇਂ ਸਿਰ ਸਾਡੇ ਤੱਕ ਇਹ ਪਹੁੰਚਦਾ ਕਰਦੇ ਨੇ